ਹਾਂ ਮੈਂ ਸੋਚਦੀ ਹਾਂ ਕਿ ਲੋਕਾਂ ਨੂੰ ਆਪਣੇ ਰਾਜ ਅਤੇ ਇੱਥੇ ਦੇ ਭੂਗੋਲ ਬਾਰੇ ਜਾਣਨਾ ਚਾਹੀਦਾ ਹੈ ਇੱਥੇ ਆਪਣੇ ਭੂਗੋਲ ਬਾਰੇ ਜਾਣਕਾਰੀ ਹੋਣੀ ਹਰ ਕਿਸੇ ਨੂੰ ਚਾਹੀਦੀ ਹੈ ਕਿ ਸਾਡੇ ਆਲੇ ਦੁਆਲੇ ਵਿੱਚ ਕੀ ਹੈ ਸਾਰੀ ਥਾਵਾਂ ਦਾ ਪਤਾ ਹੋਣਾ ਚਾਹੀਦਾ ਹੈ ਇੱਥੇ ਕਿਉਂਕਿ ਅਗਰ ਉਹਨਾਂ ਨੂੰ ਪਤਾ ਹੋਊਗਾ ਤਾਂ ਹੀ ਉਹੀ ਆਪਣੇ ਆਪਣੇ ਰਾਜ ਦਾ ਧਿਆਨ ਰੱਖ ਪਾਉਣਗੇ ਆਪਣੇ ਰਾਜ ਬਾਰੇ ਪਤਾ ਹੋਣਾ ਇੱਕ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਅਗਰ ਕੋਈ ਬਾਹਰੋਂ ਕੋਈ ਆਉਂਦਾ ਹੈ ਤਾਂ ਉਸ ਨੂੰ ਉਹ ਅਗਰ ਸਾਡੇ ਤੋਂ ਪੁੱਛਦਾ ਹੈ ਕਿ ਕਿ ਤੁਹਾਡਾ ਰਾਜ ਬਾਰੇ ਕੁਛ ਦੱਸੋ ਅਗਰ ਸਾਨੂੰ ਕੁਛ ਆਪਣੇ ਰਾਜ ਬਾਰੇ ਪਤਾ ਹੀ ਨਹੀਂ ਹੋਊਗਾ ਤਾਂ ਅਸੀਂ ਉਸਨੂੰ ਕੀ ਦੱਸਾਂਗੇ ਆਪਣੀ ਰਾਜ ਬਾਰੇ ਜਾਣਕਾਰੀ ਹੋਣਾ ਇੱਕ ਬਹੁਤ ਵਧੀਆ ਗੱਲ ਹੈ ਤਾਂ ਕਿ ਅਸੀਂ ਅੱਗੇ ਵੀ ਕਿਸੇ ਨੂੰ ਦੱਸ ਸਕੀਏ ਆਪਣੇ ਰਾਜ ਦੇ ਬਾਰੇ ਐਜੂਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਅਗਰ ਸਾਨੂੰ ਆਪਣੇ ਰਾਜ ਦੇ ਬਾਰੇ ਹੀ ਨਹੀਂ ਪਤਾ ਹੋਊਗਾ ਤਾਂ ਅਸੀਂ ਲੋਕਾਂ ਨੂੰ ਕਿਉਂ ਦੱਸਾ ਕੀ ਦੱਸਾਂਗੇ ਉਹਨਾਂ ਨੂੰ ਆਪਣੇ ਰਾਜ ਦੇ ਬਾਰੇ ਅਤੇ ਲੋਕਾਂ ਨੂੰ ਵੀ ਆਪਣੇ ਰਾਜ ਦੇ ਬਾਰੇ ਦੱਸਣਾ ਚਾਹੀਦਾ ਹੈ ਕਿ ਸਾਡੇ ਰਾਜ ਵਿੱਚ ਕੀ ਕੀ ਖੂਬੀਆਂ ਹਨ ਤਾਂ ਕਿ ਅਸੀਂ ਆਪਣੇ ਰਾਜ ਨੂੰ ਸੰਭਾਲ ਕੇ ਰੱਖ ਸਕੀਏ